ਰੂਪਨਗਰ ਜ਼ਿਲ੍ਹੇ ਦਾ ਇਤਿਹਾਸ ਬਹੁਤ ਪੁਰਾਣਾ ਅਤੇ ਵੱਡਾ ਹੈ ਇਸ ਵਿੱਚ ਪੁਰਾਣਾ ਸਮਾਂ ਅਤੇ ਪੁਰਾਣੀ ਘਟਨਾਵਾਂ ਦਾ ਵਰਨਣ ਵੀ ਕੀਤਾ ਗਿਆ ਹੈ ਹੜੱਪਾ ਸੱਭਿਆਤਾ ਜਿ ਜਿਵੇਂ ਕਿ ਉਸਦੇ ਵਿੱਚ ਪੁਰਾਣੇ ਸਮੇਂ ਵਿੱਚ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਬਾਰੇ ਦੱਸਿਆ ਗਿਆ ਹੈ ਅਤੇ ਅਤੇ ਰੋਪੜ ਜ਼ਿਲ੍ਹੇ ਵਿੱਚ ਸਭ ਤੋਂ ਇਤਿਹਾਸਕ ਸ਼ਖਸੀਅਤ ਰਾਜਾ ਭੂਪ ਸਿੰਘ ਹੈ